ਹੈਲੋ ਸਤਿ ਸ਼੍ਰੀ ਅਕਾਲ ਜੀ ਸੀਨੀਅਰ ਬੈਂਕ ਇੰਡੀਆ ਵਿਚ ਤੁਹਾਡਾ ਸਆਗਤ ਹੈ ਮੈਂ ਤੁਹਾਡੀ ਕਿਸ ਤਰ੍ਹਾਂ ਦੀ ਸਹਾਇਤਾ ਕਰ ਸਕਦਾ ਮੈਮ ਕਿਸ ਨੇਮ ਤੋਂ ਅਕਾਊਂਟ ਹੈ ਤੁਹਾਡਾ ਮੈਮ ਇਹ ਇਸ ਨੰਬਰ 'ਤੇ ਰਜਿਸਟਰ ਅਕਾਊਂਟ ਹੈ ਤੁਹਾਡਾ ਓਕੇ ਮੈਮ ਆਪ ਤੁਹਾਡੀ ਡੇਟ ਆਫ ਬਰਥ ਦੱਸੋਗੇ ਮੈਮ ਜੀ ਜੀ ਇਕ ਮਿੰਟ ਮੈਮ ਹੋਲਡ ਰੱਖੋ ਮੈਮ ਦੇਖ ਕੇ ਦੱਸਦਾ ਜੀ ਹੈਲੋ ਮੈਂ ਇੰਤਜਾਰ ਕਰਨ ਲਈ ਮੈਮ ਸ਼ਮਾ ਚਾਹੁੰਦੇ ਹਾਂ ਹਾਂਜੀ ਮੈਮ ਤੁਹਾਨੂੰ ਕੀ ਪ੍ਰੋਬਲਮ ਕੀ ਆ ਇਸ ਅਕਾਊਂਟ 'ਚ ਮੈਮ ਤੁਸੀਂ ਇਹ ਅਕਾਊਂਟ ਟ੍ਰਾਂਸਫਰ ਵੀ ਕਰਾ ਸਕਦੇ ਹੋ ਤੁਸੀਂ ਉੱਥੇ ਆਪਣੀ ਨਜਦੀਕੀ ਬਰਾਂਚ ਦੇ ਵਿੱਚ ਜੇ ਤੁਸੀਂ ਚਾਹੋ ਤਾਂ ਓਕੇ ਮੈਮ ਮੈਮ ਵੈਸੇ ਔਨਲਾਈਨ ਤਾਂ ਇਹ ਅਕਾਊਂਟ ਤੁਹਾਡਾ ਬੰਦ ਨਹੀਂ ਹੋਊਗਾ ਤੁਸੀਂ ਤੁਹਾਨੂੰ ਆਪਣੇ ਜਿਹੜੀ ਬ੍ਰਾਂਚ ਤੁਹਾਡਾ ਆਕਾਊਂਟ ਹੈ ਉੱਥੇ ਜਾ ਕੇ ਨਜ਼ਦੀਕੀ ਬਰਾਂਚ ਵਿੱਚ ਜਾ ਕੇ ਤੁਹਾਨੂੰ ਬੰਦ ਕਰਵਾਉਣਾ ਪਊਗਾ ਇੱਕ ਵਾਰੀ ਇਹ ਮੈਮ ਡਾਕੂਮੈਂਟ ਤਾਂ ਤੁਸੀਂ ਆਪਣੇ ਪਾਸਬੁੱਕ ਲੈ ਜਾਇਓ ਅਤੇ ਨਾਲ ਆਪਣਾ ਆਧਾਰ ਕਾਰਡ ਅਤੇ ਪੈਨ ਕਾਰਡ ਹਾਂਜੀ ਨਹੀਂ ਬਸ ਮੈਮ ਇਹ ਮੈਮ ਨਾਲ ਦੀ ਨਾਲ ਹੀ ਬੰਦ ਹੋ ਜਾਵੇਗਾ ਤੁਹਾਡਾ ਬੈਂਕ ਆਕਾਊਂਟ ਹਾਂਜੀ ਨਹੀਂ ਮੈਮ ਨਹੀ ਮੈਮ ਕੋਈ ਡਾਕੂਮੈਂਟ ਦੀ ਜ਼ਰੂਰਤ ਨਹੀ ਬਸ ਤੁਸੀਂ ਜਾ ਕੇ ਬੈਂਕ ਵਿੱਚ ਕਹਿਣਾ ਵੀ ਮੈਨੇ ਅਕਾਊਂਟ ਬੰਦ ਕਰਵਾਉਣਾ ਅਤੇ ਉਹਨੂੰ ਆਪਣੀ ਪ੍ਰੋਬਲਮ ਦੱਸਣੀ ਉਹ ਅਕਾਊਂਟ ਬੰਦ ਕਰ ਦੇਣਗੇ ਹੋਰ ਕੋਈ ਸੇਵਾ ਮੈਮ ਠੀਕ ਹੈ ਮੈਮ ਇੰਡੀਅਨ ਬੈਂਕ ਵਿਚ ਕਾਲ ਕਰਨ ਲਈ ਧੰਨਵਾਦ